ਮੈਨੂੰ ਭੰਗੜੇ ਦਾ ਬਹੁਤ ਸ਼ੌਕ ਹੈ ਭੰਗੜੇ ਕਰਨ ਦੇ ਨਾਲ ਆਪਣੇ ਸਰੀਰ ਦੀ ਬੜੀ ਜ਼ਿਆਦਾ ਕਸਰਤ ਹੋ ਜਾਂਦੀ ਹੈ ਕਸਰਤ ਦੇ ਨਾਲ ਦੇ ਨਾਲ ਆਪਾਂ ਨੂੰ ਮਨੋਰੰਜਨ ਵੀ ਆਪਣਾ ਬਹੁਤ ਹੁੰਦਾ ਉਸ ਦੇ ਨਾਲ ਆਪਣਾ ਅੰਗ ਅੰਗ ਖੁੱਲ੍ਹ ਜਾਂਦਾ ਹੈ ਅਤੇ ਸਰੀਰ ਦੇ ਵਿੱਚ ਨਵੀਂ ਹੀ ਚੁਸਤੀ ਐਦਾਂ ਲੱਗਦਾ ਕਿ ਬਹੁਤ ਜ਼ਿਆਦਾ ਚੁਸਤੀ ਆ ਗਈ ਆ ਆਪਣੇ ਆਪ ਨੂੰ ਬਹੁਤ ਹਲਕਾ ਹਲਕਾ ਮਹਿਸੂਸ ਕਰਦੇ ਹਾਂ

ਅਤੇ ਇੱਕ ਆਪਣਾ ਸਰੀਰ ਚੁਸਤ ਫੁਰਤ ਰਹਿੰਦਾ ਹੈ ਅਤੇ ਆਪਾਂ ਨੂੰ ਹੁਣ ਕਈ ਵਾਰੀ ਛੋਟੀਆਂ ਮੋਟੀਆਂ ਪ੍ਰੋਬਲਮਾਂ ਆਉਂਦੀਆਂ ਛੋਟੀਆਂ ਮੋਟੀਆਂ ਬਿਮਾਰੀਆਂ ਹੁੰਦੀਆਂ ਹਨ ਉਹਨਾਂ ਤੋਂ ਵੀ ਆਪਾਂ ਨੂੰ ਰਾਹਤ ਮਿਲ ਜਾਂਦੀ ਹੈ ਇਹ ਜਿਹੜਾ ਮਤਲਬ ਭੰਗੜਾ ਐਰੋਬਿਸ ਅਤੇ ਪੰਜਾਬੀ ਕਲਚਰ ਦੇ ਮਿਊਜਿਕ ਦੇ ਨਾਲ ਵੀ ਮਤਲਬ ਕਿ ਜੁੜੀ ਹੋਈ ਸੰਗੀਤ ਦਾ ਧਾਰਾ ਹੈ ਇਹ ਬਹੁਤ ਇਹ ਇਸ ਨੂੰ ਖਾਸ ਅਤੇ ਮਜ ਮੰਨੋਰੰਜਨ ਮਜ਼ੇਦਾਰ ਬਣਾਉਂਦਾ ਹੈ ਅਤੇ ਇਹਦੇ ਨਾਲ ਆਪਣੇ ਸਰੀਰ ਵਿੱਚ ਚੁਸਤੀ ਫੁਰਤੀ ਸਭ ਕੁਝ ਹੀ ਮਤਲਬ ਕਿ ਆ ਜਾਂਦਾ ਹੈ ਭੰਗੜੇ ਮੇਰੇ ਮੇਰੇ ਹਿਸਾਬ ਨਾਲ ਭੰਗੜਾ ਹਰ ਇੱਕ ਨੂੰ ਸਿੱਖਣਾ ਚਾਹੀਦਾ ਹੈ ਛੋਟਿਆਂ ਤੋਂ ਲੈ ਕੇ ਵੱਡਿਆ ਤੱਕ ਬੱਚਿਆਂ ਨੂੰ ਜੇ ਆਪਾਂ ਛੋਟੇ ਹੁੰਦੇ ਭੰਗੜਾ ਸਿਖਾ ਦੀਏ ਤਾਂ ਉਹਨਾਂ ਵਾਸਤੇ ਬਹੁਤ ਵਧੀਆ ਉਹਨਾਂ ਦੇ ਸਰੀਰ ਨੂੰ ਵੀ ਚੁਸਤ ਫੁਰਤ ਰੱਖੇਗਾ ਅਤੇ ਉਹਨਾਂ ਨੂੰ ਕੋਈ ਮਤਲਬ ਬਿਮਾਰੀ ਵੀ ਨਹੀਂ ਲੱਗੇਗੀ ਛੇਤੀ ਅਤੇ ਅਤੇ ਮੰਨੋਰੰਜਨ ਦਾ ਮੰਨੋਰੰਜਨ ਅਤੇ ਮਤਲਬ ਕਿ ਭੰਗੜੇ ਦਾ ਭੰਗੜਾ ਆਪਣਾ ਹੋ ਜਾਂਦਾ ਹੈ